ਜੇ ਪਾਣੀ ਦੀ ਸਪਲਾਈ ਦੀ ਗੱਲ ਕੀਤੀ ਜਾਵੇ ਤਾਂ ਮੇਰੇ ਮੁਤਾਬਕ ਪਾਣੀ ਦੀ ਸਪਲਾਈ ਹਰ ਵੇਲੇ ਹਰ ਵਿਅਕਤੀ ਨੂੰ ਮਿਲਣੀ ਚਾਹੀਦੀ ਹੈ ਕਈ ਵਾਰੀ ਪਾਣੀ ਸਵੇਰੇ ਛੇਤੀ ਆ ਜਾਂਦਾ ਹੈ ਅਤੇ ਕਈ ਵਾਰੀ ਬਹੁਤ ਲੇਟ ਆਉਂਦਾ ਕਈ ਵਾਰੀ ਜਦੋਂ ਸਾਨੂੰ ਬਹੁਤ ਲੋੜ ਹੁੰਦੀ ਹੈ ਉਦੋਂ ਪਾਣੀ ਬਹੁਤ ਦੇਰ ਨਾਲ ਆਉਂਦਾ ਜਦੋਂ ਲੋੜ ਨਹੀਂ ਹੁੰਦੀ ਹੈ ਉਦੋਂ ਪਾਣੀ ਛੇਤੀ ਆ ਜਾਂਦਾ ਜੇ ਟੂਟੀ ਦੀ ਪਾਣੀ ਪ੍ਰਾਪਤ ਕਰਨ ਦੀ ਗੱਲ ਕੀਤੀ ਜਾਵੇ ਤਾਂ ਟੂਟੀ ਦਾ ਪਾਣੀ ਵਧੀਆ ਤੇ ਮੰਨਿਆ ਜਾਂਦਾ ਪਰ ਉਹਨੂੰ ਸਾਫ ਨਹੀਂ ਮੰਨਿਆ ਜਾਂਦਾ ਪਾਣੀ ਕਈ ਵਾਰੀ ਸਾਨੂੰ ਸਾਫ ਮਿਲਦਾ ਹੈ ਕਈ ਵਾਰੀ ਸਾਨੂੰ ਸਾਫ ਨਹੀਂ ਮਿਲਦਾ ਕਈ ਵਾਰੀ ਪਾਣੀ 'ਚ ਮਿੱਟੀ ਅਤੇ ਕਈ ਤਰ੍ਹਾਂ ਦੇ ਇਦਾਂ ਦੀਆਂ ਚੀਜ਼ਾਂ ਸਾਨੂੰ ਮਿਲਦੀਆਂ ਨੇ ਜਿਹਦੇ ਨਾਲ ਉਹਨਾਂ ਦਾ ਵਰਤੋਂ ਕਰਨਾ ਸਾਡੇ ਲਈ ਬਹੁਤ ਔਖਾ ਕੰਮ ਹੋ ਜਾਂਦਾ ਪਾਣੀ ਸਾਨੂੰ ਮਿਲਣਾ ਚਾਹੀਦਾ ਹੈ ਅਤੇ ਪੂਰੇ ਟਾਈਮ ਤੇ ਮਿਲਣਾ ਚਾਹੀਦਾ ਪਾਣੀ ਸਾਡੀ ਇੱਕ ਲੋੜ ਹੈ ਸਾਡੀ ਇੱਕ ਜਰੂਰਤ ਹੈ ਪਾਣੀ ਦੀ ਸਪਲਾਈ ਹਰ ਇੱਕ ਨੂੰ ਮਿਲਣੀ ਚਾਹੀਦੀ ਹੈ ਟੂਟੀ ਦਾ ਪਾਣੀ ਜੀਵਨ ਵਿੱਚ ਬਹੁਤ ਵਧੀਆ ਕੰਮ ਕਰਦਾ ਹੈ ਪਰ ਫਿਲਟਰ ਦਾ ਪਾਣੀ ਜਿਹੜਾ ਕਿ ਸਾਫ ਮੰਨਿਆ ਜਾਂਦਾ ਹੈ ਉਹ ਜ਼ਿਆਦਾ ਵਧੀਆ ਹੁੰਦਾ ਹੈ ਟੂਟੀ ਦਾ ਪਾਣੀ ਬਹੁਤ ਵਾਰੀ ਗੰਦਾ ਹੁੰਦਾ ਹੈ ਅਤੇ ਪੀਣ ਲਾਇਕ ਵੀ ਨਹੀਂ ਹੁੰਦਾ ਹੈ ਪਾਣੀ ਸਾਫ ਹੋਣਾ ਸਭ ਤੋਂ ਜਿਆਦਾ ਜਰੂਰੀ ਹੈ ਅਤੇ ਪਾਣੀ ਦੀ ਬਚਤ ਉਸ ਤੋਂ ਵੀ ਜਿਆਦਾ ਜਰੂਰੀ ਧੰਨਵਾਦ